ਸਲਾਈ ਸਲਾਈ ਦਾ ਕੰਮ ਜਿਹੜਾ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਗਾ ਇਸ ਦੇ ਵਿੱਚ ਜਿਹੜਾ ਵੀ ਆਪਦੀ ਮਨਪਸੰਦ ਦੀ ਚੀਜ਼ ਹੈ ਜਿਹੜੀ ਮਰਜ਼ੀ ਉਹ ਪਾ ਸਕਦੇ ਗੇ ਸਲਵਾਰ ਸੂਟ ਫਰਾਕ ਪਲਾਜੋ ਸੂਟ ਵਗੈਰਾ ਸਾਰਾ ਕੁਛ ਆਪਦੀ ਜਿਹੜੀ ਮਨ ਮਰਜ਼ੀ ਦਾ ਬਣਾ ਕੇ ਵਧੀਆ ਤਿਆਰ ਕਰਕੇ ਪਾ ਸਕਦੇ ਹੈਗੇ ਜਿਵੇਂ ਦਾ ਵੀ ਹੋਵੇ ਉਹ ਆਪਾਂ ਹੁਣ ਜੇ ਮਰਜ਼ੀ ਇਹੋ ਜਿਹੀ ਤਿਆਰ ਕਰ ਸਕਦੇ ਹੈਗੇ ਜੇ ਆਪ ਨੂੰ ਸਟੀਚਿੰਗ ਆਉਂਦੀ ਹੋਵੇ ਵੀ ਆਪਦਾ ਕੋਈ ਵੀ ਇੰਟਰਸਟ ਹੋਵੇ ਮੇਰਾ ਸਟੀਚਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਟਰਸਟ ਸੀਗਾ ਤਾਂ ਕਰਕੇ ਮੈਂ ਸਟੀਚਿੰਗ ਵੀ ਸਿੱਖੀ ਹੈਗੀ ਇਸਦੇ ਵਿੱਚ ਮੈਂ ਆਪਦੀ ਕਹਾਣੀ ਦੱਸ ਦਿੰਦੀ ਹਾਂ ਵੀ ਮੈ ਬਹੁਤ ਸਟੀਚਿੰਗ ਦਾ ਮੈਨੂੰ ਬਹੁਤ ਸ਼ੌਂਕ ਸੀਗਾ ਮੈਂ ਨਾਲ ਪੜ੍ਹਦੇ ਪੜ੍ਹਦੇ ਸਟੀਚਿੰਗ ਸਿਖ ਲਈ ਕਿਉਂਕਿ ਮੈਨੂੰ ਇਹ ਚੀਜ਼ ਸੀਗੀ ਕਿ ਬਾਹਰ ਨਾਲੇ ਪੈਸੇ ਵੀ ਜ਼ਿਆਦਾ ਲੈਂਦੇ ਆ ਵੀ ਪੈਸੇ ਦੀ ਬੱਚਤ ਹੋਵੇਗੀ ਅਤੇ ਨਾਲੇ ਆਪਦੇ ਵਧੀਆ ਕੰਮ ਚੱਲੇਗਾ ਤਾਂ ਆਪਦਾ ਕੰਮ ਚਲਾਉਣ ਵਾਸਤੇ ਵੀ ਹੋਰ ਜ਼ਿਆਦਾਤਰ ਵੀ ਇੰਨਾ ਨਹੀਂ ਕੰਮ ਮਿਲਦਾ ਕੋਈ ਵੀ ਨਾ ਨੌਕਰੀ ਮਿਲਦੀ ਨਾ ਵਾਸਤਾ ਬਸ ਆਪਦਾ ਜਿਹੜਾ ਹੱਥੀਂ ਕੰਮ ਹੁੰਦਾ ਗਾ ਹੱਥੀਂ ਕੰਮ ਵਧੀਆ ਕਰਕੇ ਅਤੇ ਆਪਣੇ ਪੈਸੇ ਜਾਂ ਆਮਦਨ ਜਿਹੜੀ ਕਮਾ ਸਕਦੇ ਹਾਂ ਵਧੀਆ ਆਮਦਨ ਕਰ ਸਕਦੇ ਹੈਗੇ ਆਪਦਾ ਰੁਜ਼ਗਾਰ ਵੀ ਵਧੀਆ ਚਲਾ ਸਕਦੇ ਉਸ ਦੇ ਨਾਲ ਸਟੀਚਿੰਗ ਦੇ ਵਿੱਚ ਬਸ ਮੈਂ ਵੀ ਸਲਵਾਰ ਸੂਟ ਵਧੀਆ ਆਪਦੀ ਕਟਿੰਗ ਕਰਕੇ ਵਧੀਆ ਤਿਆਰ ਹੋ ਜਾਂਦਾ ਗਾ ਜਿਵੇਂ ਪਾਲਾਜੋ ਸੂਟ ਲੈ ਲਓ ਵੀ ਪਹਿਲਾਂ ਉਹਨੂੰ ਕਮੀਜ਼ ਅੱਡ ਕੱਢ ਲਓ ਅੱਡ ਕੱਟ ਲਓ ਫਿਰ ਉਤੋਂ ਬਾਅਦ ਉਹ ਦਾ ਪਲਾਜ਼ੋ ਕੱਟ ਲਓ ਅਤੇ ਫਿਰ ਉੱਤੋਂ ਬਾਅਦ ਜਿਵੇਂ ਦੇ ਵੀ ਪਹਿਰਾਵੇ ਪਾਉਣੇ ਹੈਗੇ ਉਵੇਂ ਦੇ ਹੋ ਜਾਂਦੇ ਹੈਗੇ ਵੀ ਜਿਵੇਂ ਵੀ ਸਲਵਾਰ ਸੂਟ ਕੱਟਣੀ ਹੈਗੀ ਜਿਵੇਂ ਪਾਲਾਜੋ ਸੂਟ ਕੱਟਣਾ ਗਾ ਵੀ ਉਵੇਂ ਕੱਟੇ ਜਾਂਦਾ ਗਾ ਜਿਵੇਂ ਮਰਜ਼ੀ ਉਹਨਾਂ ਨਿਸ਼ਾਨੀਆਂ ਲਾ ਲਓ ਗੁਲਾਈ ਪਾ ਲਓ ਬਹੁਤ ਹੀ ਵਧੀਆ ਵੀ ਜੇ ਕਾਟ ਹੋਏ ਮੋਢੇ ਦੀ ਤਾਂ ਬਹੁਤ ਹੀ ਜ਼ਿਆਦਾ ਵਧੀਆ ਫੀਟਿੰਗ ਆਉਂਦੀ ਹੈਗੀ ਜਾਂ ਫਿਰ ਪਲੋਈਆਂ ਉਹ ਹਿਸਾਬ ਨਾਲ ਪਾਈਆਂ ਹੋਣ ਤਾਂ ਫਿਰ ਬਹੁਤ ਹੀ ਜ਼ਿਆਦਾ ਵਧੀਆ ਪਲੋਈਆਂ ਕਰਕੇ ਹੀ ਫੀਟਿੰਗ ਵਧੀਆ ਆਉਂਦੀ ਹੈ ਜੇਕਰ ਪਲੋਈਆਂ ਵਧੀਆ ਪਾਈਆਂ ਹੋਣ ਤਾਂ ਫੀਟਿੰਗ ਵੀ ਵਧੀਆ ਆਵੇਗੀ ਤਾਂ ਕਰਕੇ ਵੀ ਜੇ ਮਰਜ਼ੀ ਸੂਟ ਸਿਉਵੋਂ ਵੀ ਆਪਾਂ ਨੂੰ ਸੂਟ ਸਿਉਣ ਦਾ ਬਸ ਬਲ ਹੋਣਾ ਚਾਹੀਦਾ ਗਾ ਪੋਂਚੇ ਬਹੁਤ ਸੋਹਣੇ ਤਿਆਰ ਕੀਤੇ ਹੋਣ ਤਾਂ ਬਹੁਤ ਹੀ ਪਸੰਦ ਆਉਂਦਾ ਸੂ ਸੂਟ ਅਗਲਿਆਂ ਨੂੰ ਤਾਂ ਫਿਰ ਜਿਵੇਂ ਮਰਜ਼ੀ ਵੀ ਤਿਆਰ ਕਰੋ ਸੂਟ ਤਾਂ ਸੂਟ ਦੀ ਬਸ ਟੋਰ ਹੋਣੀ ਚਾਹੀਦੀ ਹੈ ਸੂਟ ਜੇਕਰ ਵਧੀਆ ਸਿਊਤਾ ਹੋਵੇਗਾ ਤਾਂ ਹੀ ਦੂਜੇ ਲੋਕਾਂ ਨੂੰ ਪਸੰਦ ਆਵੇ ਗਾ ਥੈਂਕ ਯੂ